ਵਿਆਹਾਂ ਵਰਗੇ ਵੱਡੇ ਸਮਾਰੋਹਾਂ ਦੌਰਾਨ ਪਾਣੀ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਕਿਉਂਕਿ ਪਾਣੀ ਤੋਂ ਬਿਨਾਂ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਸਾਨੂੰ ਪਾਣੀ ਖਾਣਾ ਬਣਾਉਣ ਲਈ ਚਾਹੀਦਾ ਹੈ ਕਿਉਂਕਿ ਇਹਨਾਂ ਸਮਾਰੋਹਾਂ ਦੌਰਾਨ ਬਹੁਤ ਸਾਰੇ ਰਿਸ਼ਤੇਦਾਰ ਆਏ ਹੋਏ ਹੁੰਦੇ ਹਨ ਜਿਸ ਕਰਕੇ ਸਾਰਿਆਂ ਲਈ ਖਾਣਾ ਬਣਾਉਣ ਲਈ ਬਹੁਤ ਸਾਰੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਉਸ ਤੋਂ ਬਾਅਦ ਪਾਣੀ ਪੀਣ ਲਈ ਚਾਹੀਦਾ ਹੈ ਅਤੇ ਸਾਰੇ ਰਿਸ਼ਤੇਦਾਰਾਂ ਲਈ ਨਹਾਉਣ ਲਈ ਵੀ ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕੱਪੜੇ ਧੋਣ ਲਈ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਚਾਹੀਦਾ ਹੈ ਜਿਨਾਂ ਦੇ ਘਰ ਵਿੱਚ ਮੋਟਰ ਲੱਗੀ ਹੋਈ ਹੁੰਦੀ ਹੈ ਉਨਾਂ ਨੂੰ ਪਾਣੀ ਦੀ ਜ਼ਿਆਦਾ ਦਿੱਕਤ ਨਹੀਂ ਆਉਂਦੀ ਪਰ ਜਿੰਨਾਂ ਦੇ ਘਰ ਵਿੱਚ ਸਰਕਾਰੀ ਪਾਣੀ ਆਉਂਦਾ ਹੈ ਉਹ ਆਪਣੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਪਾਣੀ ਨੂੰ ਸਟੋਰ ਕਰਕੇ ਰੱਖ ਸਕਦੇ ਹਨ ਪਰ ਜਿੰਨਾਂ ਦੇ ਘਰਾਂ ਵਿੱਚ ਮੋਟਰ ਅਤੇ ਸਰਕਾਰੀ ਪਾਣੀ ਵਰਗੀ ਸਹੂਲਤ ਨਹੀਂ ਹੁੰਦੀ ਉਹ ਇਹਨਾਂ ਵਿਆਹਾਂ ਵਰਗੇ ਸਮਾਰੋਹਾਂ ਦੌਰਾਨ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਬਾਹਰੋਂ ਟੈਂਕਰ ਮੰਗਵਾ ਸਕਦੇ ਹਨ ਇਹ ਟੈਂਕਰ ਦੂਸਰੇ ਵੀ ਮੰਗਵਾ ਸਕਦੇ ਹਨ ਜਿੰਨਾਂ ਦੇ ਘਰ ਵਿੱਚ ਮੋਟਰ ਜਾਂ ਸਰਕਾਰੀ ਪਾਣੀ ਆਉਂਦਾ ਹੈ ਪਰ ਜਿੰਨਾ ਕੋਲ ਚਾਰ ਪੈਸੇ ਹੁੰਦੇ ਨੇ ਉਹ ਪੀਣ ਵਾਲੇ ਪਾਣੀ ਲਈ ਕੈਂਪਰ ਮੰਗਵਾ ਲੈਂਦੇ ਹਨ ਜਿਹੜਾ ਕਿ ਆਰ ਓ ਪਾਣੀ ਹੁੰਦਾ ਹੈ